ਭੰਗੜਾ ਐਰੋਬਿਕਸ ਦੀ ਕੋਰਿਓਗ੍ਰਾਫੀ ਇਹ ਭੰਗੜਾ ਐਰੋਬਿਕਸ ਦੋ ਚੀਜ਼ਾਂ ਮਿਕਸ ਕਰਕੇ ਤਿਆਰ ਹੁੰਦਾ ਹੈ ਜੀ ਭੰਗੜਾ ਜਿਹੜਾ ਹੈ ਉਹ ਪੰਜਾਬ ਦਾ ਬਹੁਤ ਹੀ ਪ੍ਰਚਲਿਤ ਅਤੇ ਪੁਰਾਣਾ ਫੋਕ ਡਾਂਸ ਹੈ ਅਤੇ ਅਰੋਬਿਕਸ ਜਿਹੜੀ ਹੈ ਉਹ ਤੁਹਾਡੀ ਇੱਕ ਡੇ ਟੂ ਡੇ ਲਾਈਫ ਦੇ ਵਿੱਚ ਐਕਸਰਸਾਈਜ਼ ਦਾ ਇੱਕ ਜ਼ਰੀਆ ਹੈ ਜਿਹਦੇ ਵਿੱਚ ਅੱਜ ਕੱਲ੍ਹ ਜਿਹੜੇ ਯੰਗ ਜਿਹੜੀ ਜਨਰੇਸ਼ਨ ਹੈ ਜਿਸ ਨੂੰ ਬਹੁਤ ਪਸੰਦ ਕਰਦੀ ਹੈ ਅਤੇ ਅਸੀਂ ਭੰਗੜਾ ਔਰ ਐਰੋਬੈਕਸ ਦਾ ਮਿਕਸਚਰ ਨੂੰ ਜਦੋਂ ਅਸੀਂ ਭੰਗੜੇ ਦੇ ਨਾਲ ਅਰੋਬਿਕਸ ਨੂੰ ਮਿਕਸ ਕਰ ਦਿੰਦੇ ਹਾਂ ਉਹਨੂੰ ਉਹਦੀ ਜਦੋਂ ਪਰਫੋਰਮੈਂਸ ਕੀਤੀ ਜਾਂਦੀ ਹੈ ਉਹਨੂੰ ਭੰਗੜਾ ਕੋਰੀਓਗ੍ਰਾਫੀ ਕਿਹਾ ਜਾਂਦਾ ਹੈ ਉਹਦੇ ਲਈ ਭੰਗੜੇ ਦੇ ਸਟੈਪਸ ਨੂੰ ਜਿਹੜੀਆਂ ਐਕਸਰਸਾਈਜ਼ਿਸ ਨੇ ਜਿਹੜੀਆਂ ਤੁਹਾਡੀ ਸਿਹਤ ਲਈ ਜ਼ਰੂਰੀ ਨੇ ਉਹਨਾਂ ਦੇ ਨਾਲ ਮਿਕਸ ਕਰਕੇ ਜੋ ਡਾਂਸ ਤਿਆਰ ਕੀਤਾ ਜਾਂਦਾ ਹੈ ਉਹਨੂੰ ਭੰਗੜਾ ਐਰੋਬਿਕਸ ਕਿਹਾ ਜਾਂਦਾ ਹੈ ਧੰਨਵਾਦ